ਹੈਲੋ ਹਾਂਜੀ ਵੀਰੇ ਸੰਦੀਪ ਗੱਲ ਕਰ ਰਹੇ ਹੋ ਹਾਂਜੀ ਬਾਲਾ ਜੀ ਟਰੈਵਲਰਸ ਤੋਂ ਗੱਲ ਕਰ ਰਹੇ ਹੋ ਜੀ ਹਾਂਜੀ ਵੀਰੇ ਮੈਂ ਨਾ ਇੱਕ ਗੱਡੀ ਕਰਵਾਈ ਸੀ ਤੁਹਾਡੇ ਤੋਂ ਬੁੱਕ ਡੇਢ ਕੁ ਮਹੀਨਾ ਪਹਿਲਾਂ ਅਨੋਵਾ ਕ੍ਰਿਸਟਾ ਬੁੱਕ ਕਰਵਾਈ ਸੀ ਵੀਰੇ ਅਤੇ ਸੱਤ ਕੁ ਦਿਨਾਂ ਦਾ ਟੂਰ ਸੀ ਆਪਣਾ ਸ਼ਿਮਲੇ ਲੈ ਕੇ ਗਏ ਸੀ ਗੱਡੀ ਆਪਾਂ ਅਤੇ ਉਹ ਗੱਡੀ ਵੀ ਵਧੀਆ ਸੀਗੀ ਆਪਣਾ ਡਰਾਈਵਰ ਵੀ ਬਹੁਤ ਵਧੀਆ ਸੀ ਅਤੇ ਮੈਂ ਹੁਣ ਫਿਰ ਅਗਲੇ ਹਫ਼ਤੇ ਜਾਣਾ ਟੂਰ ਲਗਾਉਣਾ ਸੀ ਹਿਮਾਚਲ ਦਾ ਕੁੱਲੂ ਵਾਲੀ ਸਾਈਡ ਅਤੇ ਮੈਂ ਚਾਹੁੰਦਾ ਸੀਗਾ ਵੀ ਆਪਾਂ ਨਾ ਉਹ ਹੀ ਗੱਡੀ ਕਰੀਏ ਜਿਹੜੀ ਉਦੋਂ ਭੇਜੀ ਸੀ ਤੁਸੀਂ ਕ੍ਰਿਸਟਾ ਭੇਜੀ ਸੀਗੀ ਇੱਕੀ ਮੋਡਲ ਇੱਕੀ ਮੋਡਲ ਕ੍ਰਿਸਟਾ ਭੇਜੀ ਸੀਗੀ ਵਾਈਟ ਕਲਰ ਦੀ ਅਤੇ ਆਪਣਾ ਡਰਾਈਵਰ ਵੀ ਮੁੰਡਾ ਵਧੀਆ ਸੀ ਮੋਨੂ ਸੀ ਸ਼ਾਇਦ ਕੋਈ ਉਹ ਵਧੀਆ ਸੀ ਮੁੰਡਾ ਨਾਈਸ ਸੀਗਾ ਅਤੇ ਮੈਂ ਜਾਣਾ ਵੀਰੇ ਫੈਮਿਲੀ ਨਾਲ ਅਤੇ ਉਹ ਬੰਦਾ ਵੀ ਆਪਣਾ ਵਧੀਆ ਨਾਲੇ ਫੈਮਿਲੀ ਵਾਲਾ ਬੰਦਾ ਵੀ ਨਾਲ ਕੋਈ ਚੱਕਰ ਨਹੀਂ ਫੈਮਿਲੀ ਦੇ ਨਾਲ ਬੰਦਾ ਮਤਲਬ ਕੋਈ ਉਹ ਡਰਿੰਕ ਵਗੈਰਾ ਕੁਛ ਨਹੀਂ ਕਰਦਾ ਸੋਫੀ ਬੰਦਾ ਉਹ ਅਤੇ ਮੈਂ ਚਾਹੁੰਦਾ ਸੀ ਨਾ ਵੀਰੇ ਵੀ ਮੈਨੂੰ ਤੁਸੀਂ ਅੱਜ ਇੱਕੀ ਤਰੀਕ ਹੋ ਗਈ

ਪੱਚੀ ਕੁ ਤਰੀਕ ਦਾ ਮੇਰਾ ਟੂਰ ਹੈ ਸੁਬਹਾ ਦਾ ਸੁਬਹਾ ਨਿਕਲਣਾ ਅੱਠ ਵਜੇ ਤਾਂ ਮੈਨੂੰ ਕੋਸ਼ਿਸ਼ ਕਰੋ ਵੀ ਉਹ ਹੀ ਗੱਡੀ ਕਰਕੇ ਦਿਓ ਸੁਬਹਾ ਅੱਠ ਅੱਠ ਵਜੇ ਤੁਸੀਂ ਮੇਰੇ ਘਰ ਭੇਜ ਦਿਓ ਗੱਡੀ ਅਤੇ ਖਰਚਾ ਮੈਨੂੰ ਦੱਸ ਦਿਓ ਅਤੇ ਪਿਛਲੀ ਵਾਰ ਤਾਂ ਜਾਇਜ਼ ਹੀ ਲਿਆ ਸੀ ਅਤੇ ਇਸ ਵਾਰ ਵੀ ਮਾੜਾ ਜਿਹਾ ਦੇਖ ਲਿਓ ਹੈ ਨਾ ਕੋਈ ਰਿਆਤ ਕਰ ਦਿਓ ਜਿੰਨੀ ਹੋ ਸਕੇ ਅਤੇ ਬਾਕੀ ਕੋਈ ਗੱਲ ਨਹੀਂ ਆਪਾਂ ਮੌਕੇ 'ਤੇ ਦੇਖ ਲਾਂਗੇ ਜੋ ਜਿੰਨਾ ਬਣਦਾ ਉੰਨਾ ਤੁਹਾਨੂੰ ਦੇਵਾਂਗੇ ਅਤੇ ਬਸ ਠੀਕ ਹੈ ਵੀਰੇ ਓਕੇ ਜੀ